ਅੱਜ ਅੱਜ ਦੇ ਭਾਰਤ ਵਿੱਚ ਬਹੁਤ ਸਾਰੀਆਂ ਮਹਿਤਪੂਰਨ ਮਹੱਤਵਪੂਰਣ ਚੁਣੌਤੀਆਂ ਹਨ ਜਿਹੜੀਆਂ ਕਿ ਸਿੱਖਿਆ ਰੁਜ਼ਗਾਰ ਸਿਹਤ ਅਤੇ ਆਦਿ ਹੁਣ ਸਿੱਖਿਆ ਦੇ ਵਿੱਚ ਮਤਲਬ ਸਰਕਾਰ ਨੂੰ ਹਰ ਕਿਤੇ ਸਕੂਲ ਖੋਲਣੇ ਚਾਹੀਦੇ ਹਨ ਅਤੇ ਜਿਵੇਂ ਕਿ ਕਈਆਂ ਛੋਟੀਆਂ ਰਾਜਾਂ ਵਿੱਚ ਜਾਂ ਵਿਲੇਜਸ ਵਿੱਚ ਸਕੂਲਜ਼ ਨਹੀਂ ਹੁੰਦੇ ਜਾਂ ਸਕੂਲਜ਼ ਹੁੰਦੇ ਆ ਉੱਥੇ ਪ੍ਰੋਪਰ ਫੈਸਿਲਿਟੀਜ਼ ਨਹੀਂ ਹੁੰਦੀਆਂ ਟੀਚਰਸ ਨਹੀਂ ਹੁੰਦੇ ਜਾਂ ਉਹਨਾਂ ਦਾ ਉੰਨਾ ਵਧੀਆ ਇੰਫਰਾਸਟਰਕਚਰ ਨਹੀਂ ਹੁੰਦਾ ਜਿਹਦੇ ਕਰਕੇ ਕਿ ਬੱਚੇ ਸਫਰ ਕਰਦੇ ਆ ਅਤੇ ਉਹਨਾਂ ਦਾ ਫਿਊਚਰ ਜਿਹੜਾ ਖਤਰੇ 'ਚ ਆ ਜਾਂਦਾ ਹੈ ਜਿਹਦੇ ਕਰਕੇ ਕਿ ਉਹਨਾਂ ਨੂੰ ਜੋਬਸ ਲੈਣ ਦੇ ਵਿੱਚ ਪ੍ਰੋਬਲਮ ਆਉਂਦੀਆਂ ਹਨ ਦੂਜਾ ਰੁਜ਼ਗਾਰ ਕੀ ਸਰਕਾਰ ਨੂੰ ਰੁਜ਼ਗਾਰ ਹਰ ਕਿਤੇ ਮੁਹੱਈਆ ਕਰਵਾਉਣਾ ਚਾਹੀਦਾ ਹੈ ਹਰ ਇੱਕ ਹਰ ਇੱਕ ਨੂੰ ਹਰ ਇੱਕ ਬੰਦੇ ਨੂੰ ਆਪਣਾ ਆਪਣੇ ਆਪ ਦੀ ਆਪਣੀ ਸਕਿਲ ਨੂੰ ਸ਼ੋ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ ਹਰ ਬੰਦਾ ਦੇ ਵਿੱਚ ਕੋਈ ਨਾ ਕੋਈ ਖੂਬੀ ਹੁੰਦੀ ਹੈ ਅਤੇ ਫਿਰ ਆ ਜਾਂਦੀ ਹੈ ਸਿਹਤ ਸਿਹਤ ਕੀ ਸਰਕਾਰ ਨੂੰ ਹਰ ਵੇਲੇ ਹੋ ਮਤਲਬ ਸਰਕਾਰੀ ਹੋਸਪਿਟਲ ਬਣਾਉਣੇ ਚਾਹੀਦੇ ਹਨ ਪ੍ਰਾਈਵੇਟ ਹੋਸਪਿਟਲਸ ਦੇ ਕਰਕੇ ਕਈ ਜਗ੍ਹਾ ਇਲਾਜ ਨਹੀਂ ਹੋ ਪਾਉਂਦੇ ਹਨ ਕਿਉਂਕਿ ਉਹਨਾਂ ਦੇ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਹੁੰਦੇ ਹਨ ਅਤੇ ਕਦੇ ਕਦਾਰ ਐਬੂਲੈਂਸ ਨੂੰ ਫੋਨ ਲਗਾਈਦਾ ਹੈ ਕਿਤੇ ਕਿਤੇ ਐਂਬੂਲੈਂਸ ਵੀ ਨਹੀਂ ਹੁੰਦੀ ਜਿਹਦੇ ਕਰਕੇ ਕਿ ਬਹੁਤ ਸਾਰੇ ਐਕਸੀਡੈਂਟਸ ਹੋ ਜਾਂਦੇ ਹਨ ਜਾਂ ਕਿਸੇ ਦੀ ਡੈਥ ਹੋ ਜਾਂਦੀ ਹੈ